ਅੱਜ ਕੱਲ੍ਹ ਜਿਸ ਤਰ੍ਹਾਂ ਪੂਰਾ ਇੰਟਰਨੈਟ ਦਾ ਜ਼ਮਾਨਾ ਆ ਗਿਆ ਹੈ ਅਤੇ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਡੇ ਖੇਤਰ ਦੇ ਵਿੱਚ ਬਹੁਤ ਕੁਝ ਚੇਂਜ ਦੀ ਜ਼ਰੂਰਤ ਹੈ ਅਗਰ ਅਸੀਂ ਬਦਲਾਵ ਚਾਹੁੰਦੇ ਹਾਂ ਤਾਂ ਸਭ ਤੋਂ ਵੱਡਾ ਬਦਲਾਵ ਇਹ ਹੋਣਾ ਚਾਹੀਦਾ ਹੈ ਕਿ ਸਾਡੇ ਖੇਤਰ ਦੇ ਵਿੱਚ ਸਭ ਤੋਂ ਜ਼ਿਆਦਾ ਸਫਲਤਾ ਲਈ ਇੱਕ ਦੂਜੇ ਦੇ ਮਾਧਿਅਮ ਨੂੰ ਸਭ ਤੋਂ ਈਜੀ ਵੇ ਦੇ ਨਾਲ ਕਰਨਾ ਚਾਹੀਦਾ ਹੈ ਸਭ ਤੋਂ ਵੱਡੀ ਗੱਲ ਇਹ ਆਉਂਦੀ ਹੈ ਕਿ ਸਾਡੀ ਸਫਲਤਾ ਦੇ ਵਿੱਚ ਸਾਡੇ ਸਰੋਤ ਜਿਸ ਤਰ੍ਹਾਂ ਕਿ ਹਰ ਤਰ੍ਹਾਂ ਦੀ ਫੈਸਿਲਿਟੀ ਸਾਡੇ ਇੱਕ ਦੂਜੇ ਦੇ ਨਾਲ ਸੰਬੰਧਿਤ ਹੋਣੀ ਚਾਹੀਦੀ ਹੈ ਸਭ ਤੋਂ ਵੱਡੀ ਗੱਲ ਮੈਨੂੰ ਇਹ ਸਮਝ 'ਚ ਆਉਂਦੀ ਹੈ ਕਿ ਜਿਹੜਾ ਕਿ ਇੱਕ ਸਾਧਨ ਹੁੰਦਾ ਹੈ ਜਿਸ ਤਰ੍ਹਾਂ ਇੱਕ ਟਰਾਂਸਪੋਰਟ ਦਾ ਸਾਧਨ ਸਾਡੇ ਖੇਤਰ ਵਿੱਚ ਸਭ ਤੋਂ ਵੱਡੀ ਚੀਜ਼ ਹੋਣੀ ਚਾਹੀਦੀ ਹੈ ਕਿ ਇੱਕ ਦੂਜੇ ਜਗ੍ਹਾ 'ਤੇ ਜਾਣ ਲਈ ਸਾਨੂੰ ਕੁਛ ਵੀ ਪਰੇਸ਼ਾਨੀਆਂ ਨਾ ਆ ਸਕਣ ਇਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਸਾਡੇ ਇੱਕ ਤੋਂ ਦੂਜੀ ਜਗ੍ਹਾ ਜਾਣ ਲਈ ਸਾਨੂੰ ਟਰਾਂਸਪੋਰਟ ਅੱਛੀ ਤਰ੍ਹਾਂ ਨਾਲ ਮੁਹੱਈਆ ਕਰਵਾਉਣੀ ਚਾਹੀਦੀ ਹੈ ਅਤੇ ਦੂਜੀ ਗੱਲ ਇੱਕ ਦੂਜੇ ਦੇ ਨਾਲ ਸੰਪਰਕ ਕਰਨ ਲਈ ਸਭ ਤੋਂ ਵੱਡੀ ਗੱਲ ਇਹ ਆਉਂਦੀ ਹੈ ਕਿ ਸਾਡੇ ਇੰਟਰਨੈਟ ਫੈਸਲਿਟੀ ਹੋਣੀ ਚਾਹੀਦੀ ਹੈ ਇਹ ਜਿਹੜੀ ਸੇਵਾਵਾਂ ਇੰਟਰਨੈਟ ਦੀਆਂ ਸੇਵਾਵਾਂ ਬਹੁਤ ਹੀ ਜ਼ਰੂਰੀ ਹੋਣੀਆਂ ਚਾਹੀਦੀਆਂ ਹੈ ਕਿਉਂਕਿ ਅਸੀਂ ਇਸ ਮਾਧਿਅਮ ਦੇ ਰਾਹੀਂ ਇੱਕ ਦੂਜੇ ਦੇ ਨਾਲ ਸੰਪਰਕ ਕਾਇਮ ਕਰ ਸਕਦੇ ਹਾਂ ਜੇ ਅਸੀਂ ਅੱਛਾ ਸੰਪਰਕ ਕਰਾਂਗੇ ਤਾਂ ਦੂਜੇ ਆਪਾਂ ਇੱਕ ਬਿਜਨਸ ਵੀ ਕਰ ਸਕਦੇ ਹਾਂ ਕਿਉਂਕਿ ਬਿਜ਼ਨਸ ਦੇ ਵਿੱਚ ਇੱਕ ਦੂਜੇ ਦੇ ਨਾਲ ਸਭ ਤੋਂ ਵਧੀਆ ਗੱਲ ਹੁੰਦੀ ਹੈ ਕਿ ਸਾਨੂੰ ਕੋਈ ਵੀ ਪਰੇਸ਼ਾਨੀ ਨਾ ਆ ਸਕੇ ਇਸ ਕਰਕੇ ਅਸੀਂ ਇੱਕ ਦੂਜੇ ਨੂੰ ਇੰਟਰਨੈੱਟ ਮਾਧਿਅਮ ਦੇ ਰਾਹੀਂ ਪੈਸੇ ਵੀ ਭੇਜ ਸਕਦੇ ਹਾਂ ਅਤੇ ਆਪਣਾ ਬਿਜਨਸ ਸੁਚਾਰੂ ਢੰਗ ਨਾਲ ਚਲਾ ਸਕਦੇ ਹਾਂ ਅਤੇ ਇਹ ਬਹੁਤ ਹੀ ਜ਼ਰੂਰੀ ਚੀਜ਼ ਹੁੰਦੀ ਹੈ ਕਿ ਆਪਣੀ ਇੱਕ ਜ਼ਿੰਦਗੀ ਨੂੰ ਅੱਛੀ ਤਰ੍ਹਾਂ ਨਾਲ ਸੇਵਾਵਾਂ ਦੇ ਨਾਲ ਅਸੀਂ ਜੀਅ ਸਕਦੇ ਹਾਂ ਅਤੇ ਆਪਣੇ ਖੇਤਰ ਵਿੱਚ ਇਹ ਸਫਲਤਾ ਦਾ ਬਹੁਤ ਹੀ ਅੱਛਾ ਸਰੋਤ ਹੋਣਾ ਜ਼ਰੂਰੀ ਹੈ ਇਸ ਕਰਕੇ ਮੈਂ ਤਾਂ ਸਭ ਚੀਜ਼ਾਂ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਅੱਛਾ ਸਮਝਦਾ ਹਾਂ ਕਿ ਜੋ ਅੱਜ ਕੱਲ੍ਹ ਦੀਆਂ ਜੋ ਤਕਨੀਕੀ ਸਾਡੇ ਲਈ ਜਿੰਨੀਆਂ ਵੀ ਸੇਵਾਵਾਂ ਉਹ ਸਾਡੇ ਖੇਤਰ ਵਿੱਚ ਹੋਣੀਆ ਚਾਹੀਦੀਆਂ ਹਨ